ਸਾਡੇ ਪਿੰਡ ਵਿੱਚ ਪਾਣੀ ਦੇ ਸਰੋਤ ਵਧੇਰੇ ਹਨ ਜਿਵੇਂ ਕਿ ਭਾਖੜਾ ਨਹਿਰ ਤੋਂ ਸੂਆ ਆਉਂਦਾ ਹੈ ਇਸ 'ਚ ਤਕਰੀਬਨ ਸਾਰਾ ਸਾਲ ਹੀ ਪਾਣੀ ਰਹਿੰਦਾ ਹੈ ਅਤੇ ਬਾਕੀ ਲੋਕਾਂ ਦੇ ਘਰਾਂ ਵਿੱਚ ਨਿੱਜੀ ਸਮਰਸੀਬਲ ਪੰਪ ਲੱਗੇ ਹੋਏ ਨੇ ਜੋ ਕਿ ਸਾਰਾ ਸਾਲ ਹੀ ਪਾਣੀ ਉਪਲਬਧ ਕਰਵਾਉਂਦੇ ਨੇ ਇਹ ਬਿਜਲੀ 'ਤੇ ਚੱਲਦੇ ਨੇ ਅਤੇ ਇੱਕ ਇਸ ਤਰ੍ਹਾਂ ਦਾ ਹੀ ਸਮਰਸੀਬਲ ਜੋ ਪੰਚਾਇਤ ਨੇ ਲਗਵਾਇਆ ਹੈ ਅਤੇ ਉਹ ਵੀ ਘਰਾਂ ਨੂੰ ਪਾਣੀ ਸਪਲਾਈ ਕਰਦਾ ਹੈ ਜੇ ਕਿਤੇ ਇਹ ਜਿਹੜਾ ਸਾਂਝਾ ਸਮਰਸੀਬਲ ਖਰਾਬ ਹੋ ਜਾਵੇ ਤਾਂ ਨਿੱਜੀ ਸਮਰਸੀਬਲਾਂ ਦੀ ਵਰਤੋਂ ਲੋਕ ਕਰ ਲੈਂਦੇ ਨੇ ਬਾਕੀ ਪਿੰਡ ਦਾ ਪਾਣੀ ਜਿਹੜਾ ਹੈ ਸੀਵਰੇਜ ਦਾ ਜਿਹੜਾ ਪਾਣੀ ਬਾਥਰੂਮਾਂ ਦਾ ਲੈਟਰੀਨਾਂ ਦਾ ਉਹ ਟਰੀਟਮੈਂਟ ਪਲਾਂਟ ਵਿੱਚ ਜਾਂਦਾ ਹੈ ਅਤੇ ਪਾਣੀ ਸਾਫ ਕਰਕੇ ਖੇਤੀ ਦੇ ਵਾਸਤੇ ਵਰਤਿਆ ਜਾਂਦਾ ਹੈ ਮੀਂਹ ਦਾ ਪਾਣੀ ਪਿੰਡ ਦੇ ਛੱਪੜ ਵਿੱਚ ਇਕੱਠਾ ਕੀਤਾ ਜਾਂਦਾ ਹੈ ਇਹ ਵੀ ਖੇਤੀ ਵਾਸਤੇ ਵਰਤਿਆ ਜਾਂਦਾ ਹੈ ਸੋ ਕੁਲ ਮਿਲਾ ਕੇ ਸਾਰਾ ਸਾਲ ਹੀ ਪਾਣੀ ਦਾ ਉਪਲਬਧ ਪਾਣੀ ਉਪਲਬਧ ਰਹਿੰਦਾ ਹੈ ਅਤੇ ਕੋਈ ਥੋੜ੍ਹ ਨਹੀਂ ਮਹਿਸੂਸ ਹੁੰਦੀ ਅਤੇ ਇਹ ਪਾਣੀ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਂਦੀ ਹੈ ਪਿੰਡ ਵਾਸੀਆਂ ਵੱਲੋਂ ਅਤੇ ਇਸ ਕਰਕੇ ਪਾਣੀ ਦਾ ਪ੍ਰਬੰਧ ਅੱਛਾ ਹੈ